ਜਿਵੇਂ ਕਿ ਅੱਜ ਕੱਲ੍ਹ ਕਈ ਤਰ੍ਹਾਂ ਦੇ ਵਾਇਰਸ ਚੱਲ ਰਹੇ ਨੇ ਥੋੜ੍ਹੇ ਸਮਾਂ ਪਹਿਲਾਂ ਹੀ ਕਰੋਨਾ ਵਾਇਰਸ ਨਿਕਲ ਕੇ ਗਿਆ ਹੈ ਅਤੇ ਦੇਖਿਆ ਜਾਵੇ ਉਸ ਤੋਂ ਬਾਅਦ ਬਹੁਤ ਸੇ ਲੋਕਾਂ ਨੂੰ ਕਿੰਨੀ ਤਰ੍ਹਾਂ ਦੀਆਂ ਬਿਮਾਰੀਆਂ ਆ ਚੁੱਕੀਆਂ ਨੇ ਕਿਸੇ ਨੂੰ ਬੀ ਪੀ ਦੀ ਦਿੱਕਤ ਹੈ ਕਿਸੇ ਨੂੰ ਬੁਖਾਰ ਰਹਿਣ ਲੱਗ ਗਿਆ ਕਿਸੇ ਨੂੰ ਖਾਂਸੀ ਜ਼ੁਕਾਮ ਜ਼ਿਆਦਾ ਰਹਿਣ ਲੱਗ ਗਏ ਨੇ ਅਤੇ ਤਕਰੀਬਨ ਹਰ ਇੱਕ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਛੋਟੀ ਤੋਂ ਲੈ ਕੇ ਵੱਡੀ ਵੱਡੀ ਤੋਂ ਲੈ ਕੇ ਛੋਟੀ ਕੋਈ ਨਾ ਕੋਈ ਬਿਮਾਰੀ ਜ਼ਰੂਰ ਚੱਲ ਰਹੀ ਹੈ ਅਤੇ ਨਵੇਂ ਜੰਮੇ ਬੱਚਿਆਂ ਦੀ ਜਿਹੜੀ ਇੰਮੀਊਨਟੀ ਹੁੰਦੀ ਹੈ ਜਿਹੜੀ ਉਹਨਾਂ ਦੀ ਪਾਚਣ ਸ਼ਕਤੀ ਹੁੰਦੀ ਉਹ ਬਹੁਤ ਹੀ ਜ਼ਿਆਦਾ ਕਮਜ਼ੋਰ ਹੁੰਦੀ ਹੈ ਅਤੇ ਨਵੇਂ ਬੱਚਿਆਂ ਨੂੰ ਜਿੰਨਾ ਹੀ ਜਿੰਨਾ ਵੀ ਹੋ ਸਕੇ ਅਸੀਂ ਦੂਸਰੇ ਲੋਕਾਂ ਦੇ ਨਵੇਂ ਲੋਕਾਂ ਦੇ ਜਾਂ ਫਿਰ ਜੇ ਕਹੀਏ ਕਿ ਬੱਚਾ ਘਰ ਦੇ ਵਿੱਚ ਹੋਇਆ ਅਤੇ ਜਿਹੜੇ ਕੋਈ ਲੋਕ ਬਾਹਰੋਂ ਆ ਰਹੇ ਨੇ ਉਹਨਾਂ ਦੇ ਸੰਪਰਕ ਤੋਂ ਦੂਰ ਰੱਖਣ ਰੱਖਿਆ ਜਾਵੇ ਤਾਂ ਕਿ ਬੱਚਿਆਂ ਵਾਸਤੇ ਉਹ ਸਥਿਤੀਆਂ ਪੈਦਾ ਨਾ ਹੋਣ ਕਿ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਛੂਹ ਸਕੇ ਆਪਾਂ ਕਈ ਤਰ੍ਹਾਂ ਦੇ ਉਹਦੇ ਵਾਸਤੇ ਯਤਨ ਕਰ ਸਕਦੇ ਹਾਂ ਜਿਵੇਂ ਕਿ ਘਰ 'ਚ ਕੋਈ ਆਇਆ ਹੈ ਤਾਂ ਪਹਿਲਾਂ ਉਹਨੂੰ ਦਸ ਪੰਦਰ੍ਹਾਂ ਮਿੰਟ ਦੂਸਰੇ ਕਮਰੇ 'ਚ ਬਿਠਾਇਆ ਜਾਵੇ ਉਹਦੇ ਹੱਥ ਧਵਾਏ ਜਾਣ ਉਸਨੂੰ ਸੈਨੀਟਾਈਜ ਦਿੱਤਾ ਜਾਵੇ ਕਿ ਤੁਸੀਂ ਆਪਣੇ ਹੱਥ ਸਾਫ ਕਰੋ ਤੁਸੀਂ ਅਗਰ ਬੱਚੇ ਨੂੰ ਚੁੱਕਣਾ ਹੈ ਤਾਂ ਬੱਚੇ ਨੂੰ ਚੁੱਕੋ ਲੇਕਿਨ ਬੱਚੇ ਨੂੰ ਚੁੰਮੋ ਨਾ ਬੱਚੇ ਨੂੰ ਦੇ ਮੂੰਹ 'ਤੇ ਹੱਥ ਨਾ ਲਗਾਓ ਬੱਚੇ ਨੂੰ ਕੁਝ ਵੀ ਖਾਣ ਵਾਸਤੇ ਨਾ ਦਿੱਤਾ ਜਾਵੇ ਇੱਦਾਂ ਦੀਆਂ ਚੀਜ਼ਾਂ ਹੈ ਕਿ ਆਪਾਂ ਨਵੇਂ ਜਨਮੇ ਬੱਚਿਆਂ ਨੂੰ ਸਵੱਛ ਵਾਤਾਵਰਨ ਦੇ ਸਕਦੇ ਹਾਂ ਘਰ ਨੂੰ ਸੈਨੀਟਾਈਜ਼ ਰੱਖੀਏ ਕਮਰੇ ਦੇ ਅੰਦਰ ਜੇ ਕਿਸੇ ਨੂੰ ਕੋਈ ਖਾਂਸੀ ਜ਼ੁਕਾਮ ਹੈ ਤਾਂ ਉਹ ਨਾ ਆਵੇ ਜਿਸ ਤਰ੍ਹਾਂ ਆਪਾਂ ਆਪਣੇ ਬੱਚੇ ਨੂੰ ਸੁਰੱਖਿਅਤ ਰੱਖ ਸਕਦੇ ਹਾਂ ਧੰਨਵਾਦ